ਗੱਤਕੇ ਵਿੱਚ ਖਾਸ ਹੀ ਹਥਿਆਰ ਵਰਤੇ ਜਾਂਦੇ ਹਨ ਜਿਵੇਂ ਕਿਰਪਾਨ ਨਾਗਣੀ ਚੱਕਰ ਕਿਰਪਾਨ ਨੂੰ ਮੁੱਠਾ ਹੁੰਦਾ ਅਤੇ ਉਹਨੂੰ ਘੁੱਟ ਕੇ ਸ ਸਿਰਾ ਤਿੱਖਾ ਕਰਕੇ ਬਣਾਈ ਜਾਂਦੀ ਹੈ ਅਤੇ ਗੋਲ ਚੱਕਰ ਘੁੰਮਾ ਕੇ ਉੱਪਰ ਅਤੇ ਉਹ ਖੇਡੇ ਜਾਂਦੇ ਆ ਜਦੋਂ ਨਗਰ ਕੀਰਤਨ ਹੁੰਦਾ ਉਦੋਂ ਖਾਸ ਮੌਕੇ 'ਤੇ ਖੇਡੇ ਜਾਂਦੇ ਆ ਨਾਗਣੀ ਹੁੰਦੀ ਆ ਉਹਨੂੰ ਘੁੰਮਾ ਕੇ ਅਤੇ ਉਹਦੇ ਜੋਹਰ ਦਿਖਾਏ ਜਾਂਦੇ ਹਨ ਉਹ ਬਲਾਂ ਵਾਲੀ ਵੀ ਹੁੰਦੀ ਹੈ